ਅੱਜ ਕੱਲ੍ਹ ਟੈਕਨੋਲਜੀ ਇੰਨੀ ਕੁ ਵੱਧ ਚੁੱਕੀ ਹੈ ਕਿ ਲੋਕ ਕੈਮਰੇ ਦੇ ਤੌਰ 'ਤੇ ਆਪਣਾ ਫੋਨ ਹਰ ਵੇਲੇ ਯੂਜ ਕਰਦੇ ਹਨ ਲੋਕ ਆਪਣੇ ਪੁਰਾਣੀਆਂ ਤਸਵੀਰਾਂ ਦੇਖ ਸਕਦੇ ਹਨ ਲੋਕ ਆਪਣੀਆਂ ਯਾਦਾਂ ਤਾਜ਼ਾ ਕਰ ਸਕਦੇ ਹਨ ਅਤੇ ਆਪਣੀਆਂ ਫੋਟੋਆਂ ਇੰਸਟਾ ਸਨੈਪਚੈਟ ਅਤੇ ਹੋਰ ਸੋਸ਼ਲ ਮੀਡੀਆ 'ਤੇ ਪੋਸਟ ਕਰਦੇ ਹਨ ਜਿਸ ਨਾਲ ਉਹਨਾਂ ਨੂੰ ਰੀਚ ਮਿਲ ਸਕਦੀ ਹੈ ਅਤੇ ਹੋਰ ਵੀ ਫੇਮ ਮਿਲ ਸਕਦੀ ਹੈ ਮੈਨੂੰ ਵੀ ਇਹ ਸੋਸ਼ਲ ਮੀਡੀਆ 'ਤੇ ਇੰਸਟਾ 'ਤੇ ਪੋਸਟ ਕਰਨ ਦੇ ਸ਼ੌਂਕ ਹੈ ਇਸ ਕਰਕੇ ਫੋਟੋਗ੍ਰਾਫੀ ਵੀ ਮੇਰਾ ਸ਼ੌਕ ਬਣ ਚੁੱਕਿਆ ਹੈ ਅਤੇ ਮੈਨੂੰ ਕੁਦਰਤ ਦੀਆਂ ਫੋਟੋਆਂ ਖਿੱਚਣੀਆਂ ਬਹੁਤ ਪਸੰਦ ਹੈ ਕੁਦਰਤ ਦਾ ਦ੍ਰਿਸ਼ ਬਹੁਤ ਸੋਹਣਾ ਹੁੰਦਾ ਹੈ ਇਸ ਕਰਕੇ ਇਸ ਦੀਆਂ ਫੋਟੋਆਂ ਵਧੀਆ ਆਉਂਦੀਆਂ ਹਨ